ਪੇਂਟਿੰਗ ਦੇ ਵਿੱਚ ਰੁਚੀ ਮੈਨੂੰ ਆਪਣੇ ਸਕੂਲ ਦੁਆਰਾ ਮਿਲੀ ਹੈ ਪੇਂਟਿੰਗ ਦੀ ਹਰ ਇੱਕ ਕਲਾ ਮੈਂ ਆਪਣੇ ਸਕੂਲ ਦੇ ਵਿੱਚੋਂ ਹੀ ਸਿੱਖੀ ਹੈ ਸਕੂਲ ਦੇ ਟੀਚਰਸ ਤੋਂ ਸਿੱਖੀ ਹੈ ਮੇਰੀ ਪੇਂਟਿੰਗ ਦੇ ਵਿੱਚ ਕਾਫੀ ਜ਼ਿਆਦਾ ਰੁਚੀ ਹੈ ਸਭ ਤੋਂ ਮੁਸ਼ਕਲ ਅਤੇ ਔਖੀ ਪੇਂਟਿੰਗ ਮੈਨੂੰ ਪੋਰਟਰੇਟ ਪੇਂਟਿੰਗ ਲੱਗਦੀ ਹੈ ਇਸ ਪੇਂਟਿੰਗ ਨੂੰ ਬਣਾਉਣਾ ਮੈਂ ਸਮ ਸਮਝਦਾ ਹਾਂ ਕਿ ਕਾਫੀ ਮੁਸ਼ਕਲ ਹੈ ਹਰ ਇੱਕ ਪੇਂਟਰ ਪੋਰਟਰੇਟ ਪੇਂਟਿੰਗ ਨਹੀਂ ਬਣਾ ਸਕਦਾ ਹੈ ਪੋਰਟਰੇਟ ਪੇਂਟਿੰਗ ਨੂੰ ਬਣਾਉਣ ਵਾਸਤੇ ਤੁਹਾਨੂੰ ਕਾਫੀ ਬਰੀਕੀ ਦੇ ਵਿੱਚ ਜਾਣਾ ਪੈਂਦਾ ਹੈ ਜੋ ਕਿੱਸਾ ਮੈਂ ਤੁਹਾਡੇ ਨਾਲ ਪੇਂਟਿੰਗ ਦਾ ਸਾਂਝਾ ਕਰਨਾ ਚਾਹੁੰਦਾ ਹਾਂ ਉਹ ਇੱਕ ਪੋਰਟਰੇਟ ਪੇਂਟਿੰਗ ਦਾ ਹੀ ਹੈ ਮੈਂ ਪੋਰਟਰੇਟ ਪੇਂਟਿੰਗ ਕਾਫੀ ਸਮਾਂ ਲਗਾ ਕੇ ਸਿੱਖੀ ਹੈ ਮੈਨੂੰ ਪੋਰਟਰੇਟ ਪੇਂਟਿੰਗ ਬਣਓ ਬਣਾਉਣ ਲਈ ਕਾਫੀ ਸਿੱਖਣ ਲਈ ਬਣਓ ਸਿੱ ਬਣਾੳ ਬਣਾਉਣ ਵਾਸਤੇ ਸਿੱਖਣ ਲਈ ਕਾਫੀ ਸਮਾਂ ਲੱਗ ਗਿਆ ਤਕਰੀਬਨ ਮੈਂ ਮੰਨਦਾ ਹਾਂ ਕਿ ਮੈਨੂੰ ਤਿੰਨ ਸਾਲ ਲੱਗ ਗਏ ਕਿ ਮੈਂ ਇੱਕ ਪੋਰਟਰੇਟ ਪੇਂਟਿੰਗ ਬਣਾਉਣ ਯੋਗ ਹੋ ਸਕਾਂ ਇੱਕ ਅੱਛੀ ਪੋਰਟਰੇਟ ਪੇਂਟਿੰਗ ਬਣਾਉਣ ਯੋਗ ਹੋ ਸਕਾਂ ਇਸ ਵਿੱਚ ਕਾਫੀ ਯੋਗਦਾਨ ਮੇਰੇ ਟੀਚਰਸ ਦਾ ਹੈ ਪੋਰਟਰੇਟ ਪੇਂਟਿੰਗ ਬਣਾਉਣ ਵਾਸਤੇ ਤੁਹਾਨੂੰ ਕਾਫੀ ਬਰੀਕੀ ਦੇ ਨਾਲ ਕ ਇਕੱਲਾ ਇਕੱਲਾ ਐਕਸਪ੍ਰੈਸ਼ਨ ਹੂ ਬ ਹੂ ਉਤਾਰਨਾ ਪੈਂਦਾ ਹੈ ਜਿਸ ਨਾਲ ਤੁਹਾਡੀ ਪੇਂਟਿੰਗ ਦਾ ਮੁੱਲ ਵੱਧਦਾ